ਉੱਦਾਂ ਤਾਂ ਮੈਨੂੰ ਕਿਸੇ ਵੀ ਚੀਜ਼ ਲਈ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕਰਜ਼ਾ ਨਹੀਂ ਲੈਣਾ ਪਿਆ ਪਰ ਮੈਂ ਸਾਨੂੰ ਕਰਜ਼ਾ ਲੈਣ ਦੇ ਲਈ ਜੋ ਸਾਡਾ ਸਿਵਿਲ ਸਕੋਰ ਹੈ ਉਹ ਵਧੀਆ ਹੋਣਾ ਚਾਹੀਦਾ ਹੈ ਅਸੀਂ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਤੋਂ ਜਾ ਕੇ ਆਪਣੇ ਡਾਕੂਮੈਂਟਸ ਦੇ ਨਾਲ ਕਰਜ਼ਾ ਲੈ ਸਕਦੇ ਹਾਂ